ਮੇਰਾ ਹਰ ਸਮੇਂ ਮਨਪਸੰਦ ਪਕਵਾਨ ਹੈ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਇਹ ਮੈਨੂੰ ਬਹੁਤ ਪਸੰਦ ਹੈ ਇਹ ਜਦੋਂ ਕਤ ਸਾਗ ਜਦੋਂ ਕਿ ਖੁਦ ਪੈਲੀਆਂ 'ਚੋਂ ਤੋੜਿਆ ਜਾਂਦਾ ਕੂਲਾ ਕੂਲਾ ਸਾਗ ਗੰਦਲਾਂ ਕੂਲੀਆਂ ਕੂਲੀਆਂ ਹੁੰਦੀਆਂ ਹਨ ਜਦੋਂ ਇਸ ਨੂੰ ਬਣਾਇਆ ਜਾਂਦਾ ਹੈ ਤਾਂ ਇਸ ਦਾ ਸਵਾਦ ਹੀ ਵੱਖਰਾ ਆਉਂਦਾ ਹੈ ਇਸਦੀ ਸਮੈਲ ਇਹਦੀ ਇਹਦੀ ਖੁਸ਼ਬੂ ਹੀ ਬਹੁਤ ਵਧੀਆ ਲੱਗਦੀ ਹੈ ਹੁਣ ਤਾਂ ਸਾਗ ਨੂੰ ਕੂ ਕੂੱਕਰਾਂ ਵਿੱਚ ਬਣਾਇਆ ਜਾਂਦਾ ਹੈ ਪਰ ਜਦੋਂ ਅਸੀਂ ਇਸ ਨੂੰ ਤੋੜੀ ਵਿੱਚ ਬਣਾਉਂਦੇ ਹਾਂ ਉਹ ਸਾਗ ਦਾ ਵੱਖਰਾ ਹੀ ਆਨੰਦ ਆਉਂਦਾ ਹੈ ਸ ਸਵੇਰ ਦਾ ਸਾਗ ਧਰਿਆ ਹੋਵੇ ਕਿਤੇ ਸ਼ਾਮੀ ਜਾ ਕੇ ਮੱਧਮ ਸੇਕ 'ਤੇ ਜਦੋਂ ਰਿੱਝਦਾ ਸਾਗ ਸਾਗ ਦੀ ਖੁਸ਼ਬੂ ਹੀ ਮਨ ਨੂੰ ਖਿੱਚਦੀ ਹੈ ਅਤੇ ਫਿਰ ਜਦੋਂ ਇਸਨੂੰ ਆਪਾਂ ਮੱਕੀ ਦੀ ਰੋਟੀ ਨਾਲ ਪਹਾੜੀ ਮੱਕੀ ਦਾ ਆਟਾ ਜਦੋਂ ਹੋਵੇ ਜਾਂ ਇਸ ਤਰ੍ਹਾਂ ਮੱਕੀ ਜਦੋਂ ਆਪਾਂ ਘਰਾਂ ਵਾਲੀ ਮੱਕੇ ਦਾ ਅਸੀਂ ਜਦੋਂ ਆਟਾ ਅਸੀਂ ਪਿਸਵਾਉਂਦੇ ਆ ਤਾਂ ਫਿਰ ਉਹਦਾ ਮੈਨੂੰ ਬਹੁਤ ਹੀ ਆਨੰਦ ਆਉਂਦਾ ਹੈ ਜਦੋਂ ਸਾਗ ਸਾਰਾ ਦਿਨ ਰਿੱਝ ਕੇ ਜਦੋਂ ਬਣ ਜਾਂਦਾ ਹੈ ਸ਼ਾਮ ਤੱਕ ਮੱਧਮ ਸੇਕ ਦੇ ਰਿੱਝਦਾ ਹੈ ਅਤੇ ਫਿਰ ਜਦੋਂ ਇਸਨੂੰ ਮੱਕੀ ਦੀ ਰੋਟੀ ਨਾਲ ਖਾਧਾ ਜਾਂਦਾ ਹੈ ਤਾਂ ਬਹੁਤ ਹੀ ਆਨੰਦ ਆਉਂਦਾ ਹੈ ਉਹਦੇ ਵਿੱਚ ਦੇਸੀ ਘਿਓ ਪਾ ਕੇ ਬਹੁਤ ਹੀ ਮੱਖਣ ਪਾ ਕੇ ਅਤੇ ਜਾਂ ਇਸ ਨੂੰ ਜਦੋਂ ਆਪਾਂ ਲੱਸੀ ਦੇ ਨਾਲ ਬਾਅਦ 'ਚ ਜਦੋਂ ਲੱਸੀ ਦਾ ਗਲਾਸ ਪੀਂਦੇ ਹਾਂ ਤਾਂ ਬਹੁਤ ਹੀ ਆਨੰਦ ਆ ਜਾਂਦਾ ਹੈ ਇਸ ਨੂੰ ਬਾਰ ਬਾਰ ਖਾਣ 'ਤੇ ਵੀ ਮਨ ਨਹੀਂ ਅੱਕਦਾ ਬਸ ਇਹੀ ਸ ਸਾਡੇ ਪੰਜਾਬ ਦੀ ਸ਼ਪੈਸ਼ਲ ਡਿਸ਼ ਮੰਨਿਆ ਜਾਂਦਾ ਹੈ ਇਹ ਕਿਤੋਂ ਵੀ ਖਾ ਲਓ ਪਰ ਆਪਾਂ ਕਿਤੇ ਵੀ ਜਾ ਕੇ ਜਦੋਂ ਇਹ ਖਾ ਪਕਵਾਨ ਖਾਂਦੇ ਹਾਂ ਪਰ ਜੋ ਸਾਡੇ ਇੱਥੇ ਪੰਜਾਬ ਦੇ ਸਾਗ ਦਾ ਸਵਾਦ ਹੈ ਇਹ ਸਵਾਦ ਸਾਨੂੰ ਕਿਤੋਂ ਵੀ ਨਹੀਂ ਮਿਲਦਾ ਇਸ ਲਈ ਮੈਨੂੰ ਇਹ ਬਹੁਤ ਹੀ ਪਸੰਦ ਹੈ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਅਤੇ ਨਾਲ ਲੱਸੀ ਦਾ ਗਿਲਾਸ ਹੋਵੇ ਤਾਂ ਬਹੁਤ ਹੀ ਆਨੰਦ ਆ ਜਾਂਦਾ ਹੈ ਧੰਨਵਾਦ